ਭੰਗੜਾ ਪੰਜਾਬ ਦਾ ਲੋਕ ਨਾਚ ਹੈ ਅਤੇ ਪੰਜਾਬ ਵਿੱਚ ਇਸ ਦੀ ਸ਼ੁਰੂਆਤ ਇਸ ਤਰ੍ਹਾਂ ਹੁੰਦੀ ਹੈ ਕਿ ਜਦੋਂ ਕਿਸਾਨ ਪੰਜਾਬੀ ਕਿਸਾਨ ਜਦੋਂ ਆਪਣੀ ਫ਼ਸਲ ਨੂੰ ਝੂਮਦੇ ਲਹਿਰਾਉਂਦੇ ਦੇਖਦਾ ਹੈ ਔਰ ਦੇਖਦਾ ਹੈ ਕਿ ਉਹ ਕਿੰਨੀ ਅੱਛੇ ਤਰੀਕੇ ਨਾਲ ਪੱਕ ਚੁੱਕੀ ਹੈ ਤਾਂ ਉਸ ਦਾ ਦਿਲ ਖੁਸ਼ੀ ਨਾਲ ਜਦੋਂ ਭਰ ਜਾਂਦਾ ਸੀਗਾ ਤਾਂ ਉਸ ਵੇਲੇ ਉਹ ਖੁਸ਼ੀ ਵਿੱਚ ਆ ਕੇ ਇਹ ਲੋਕ ਨਾਚ ਜਿਸ ਨੂੰ ਆਪਾਂ ਭੰਗੜਾ ਕਹਿੰਦੇ ਹਾਂ ਉਹ ਕਰਦਾ ਸੀ ਔਰ ਭੰਗੜੇ ਦੇ ਜੋ ਸਟੈਪਸ ਨੇ ਜੋ ਤਾਲਾਂ ਨੇ ਉਹ ਇਸ ਤਰ੍ਹਾਂ ਦੀਆਂ ਨੇ ਕਿ ਉਸ ਵਿੱਚ ਖੁਸ਼ੀ ਔਰ ਝੂਮਣਾ ਔਰ ਇਹ ਸਭ ਚੀਜ਼ਾਂ ਨੇ ਜੋ ਕਿ ਠੀਕ ਹੈ ਜਦੋਂ ਅਸੀਂ ਕਸਰਤ ਕਰਦੇ ਹਾਂ ਕਸਰਤ ਦੇ ਜਿਹੜੇ ਬਾਕੀ ਵਿਕਲਪ ਹੈ ਉਹ ਕਰ ਕਰਦੇ ਹਾਂ ਤਾਂ ਠੀਕ ਹੈ ਸਾਡੇ ਸਰੀਰ ਨੂੰ ਵਰਜਿਸ਼ ਜ਼ਰੂਰ ਹੁੰਦੀ ਹੈ ਸਰੀਰ ਦੀ ਸਾਨੂੰ ਖੁਸ਼ੀ ਵੀ ਮਿਲਦੀ ਹੈ ਪਰ ਉਸ ਨਾਲ ਜੋ ਭੰਗੜਾ ਹੈ ਜੋ ਲੋਕ ਨਾਚ ਹੈ ਉਸਦੇ ਨਾਲ ਜਿਹੜੀ ਉਸਦੇ ਅੰਦਰ ਦੀ ਤਸਦੀਕ ਹੈ ਜੋ ਖੁਸ਼ੀ ਹੈ ਉਹ ਸਾਨੂੰ ਜੋ ਹੈ ਉਹ ਹੋਰ ਜੋ ਵਿਕਲਪ ਨੇ ਸਰੀਰ ਜੋ ਕਸਰਤ ਦੇ ਉਸ ਵਿੱਚੋਂ ਮਿਲਨੀ ਤੋ ਕੁਛ ਹੱਦ ਤੱਕ ਮੁਸ਼ਕਿਲ ਹੈ ਭੰਗੜਾ ਸੰਗੀਤ ਢੋਲ ਇਹਨਾਂ ਚੀਜ਼ਾਂ ਨੂੰ ਲੈ ਕੇ ਚਲਦਾ ਹੈ ਕਿਸੇ ਜਿਸ ਦੇ ਨਾਲ ਕੀ ਸਾਡਾ ਸਰੀਰ ਜਦੋਂ ਤਾਲ ਦੇ ਉੱਤੇ ਨੱਚਦਾ ਹੈ ਤਾਂ ਵਰਜਿਸ਼ ਦੇ ਨਾਲ ਨਾਲ ਸਾਡੇ ਦਿਲ ਨੂੰ ਜੋ ਖੁਸ਼ੀ ਮਿਲਦੀ ਹੈ ਸਾਡਾ ਮਨ ਜੋ ਝੂਮਦਾ ਹੈ ਉਹ ਤਾਂ ਸਿਰਫ਼ ਭੰਗੜੇ ਨਾਲ ਹੀ ਹੋ ਸਕਦਾ ਹੈ